ਮਨਪਸੰਦ ਹਵਾਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਸੰਗ੍ਰਹਿ ਬਿਰਹਾ ਤੂੰ ਸੁਲਤਾਨ ਵਿੱਚੋਂ ਇੱਕ ਗਜ਼ਲ ਦਾ ਟੋਟਾ ਜੋ ਕਿ ਇਸ ਪ੍ਰਕਾਰ ਹੈ ਨਾ ਝੰਗ ਛੁਟਿਆ ਅਤੇ ਨਾ ਕੰਨ ਪਾਟੇ ਟੋਲਾ ਲੰਘ ਗਿਆ ਇੰਝ ਹੀਰਾਂ ਦਾ ਇਹ ਸਥਿਤੀ ਮੈਨੂੰ ਆਪਣੇ ਨਜ਼ਦੀਕ ਦੀ ਲੱਗਦੀ ਹੈ ਕਿਉਂਕਿ ਜਿਹੜੀ ਸ਼੍ਰੇਣੀ ਵੰਡ ਸਮਾਜ ਦੇ ਵਿੱਚ ਕੀਤੀ ਗਈ ਹੈ ਉਸ ਦੇ ਵਿੱਚ ਜੋ ਮੱਧਵਰਗੀ ਬੰਦਾ ਹੈ ਉਹ ਸਾਰੀ ਜ਼ਿੰਦਗੀ ਵਿੱਚ ਸਫਰ ਹੀ ਕਰਦਾ ਹੈ ਨਾ ਤਾਂ ਉਸ ਦੀਆਂ ਉਮੀਦਾਂ ਪੂਰੀਆਂ ਹੁੰਦੀਆਂ ਹਨ ਅਤੇ ਜੋ ਉਹ ਸੁਪਨੇ ਵੀ ਦੇਖਦਾ ਹੈ ਉਹ ਵੀ ਵਿੱਚ ਵਿਚਾਲੇ ਹੀ ਕਿਤੇ ਰਹਿ ਜਾਂਦੇ ਹਨ ਅਤੇ ਇਸ ਗੱਲ ਨੂੰ ਸ਼ਿਵ ਨੇ ਬੜੀ ਬੇਵਾਕੀ ਨਾਲ ਕਿਹਾ ਹੈ ਕਿ ਨਾ ਝੰਗ ਛੁਟਿਆ ਅਤੇ ਨਾ ਕੰਨ ਪਾਟੇ ਮਤਲਬ ਕਿ ਬੰਦਾ ਸੰਘਰਸ਼ ਤਾਂ ਬਹੁਤ ਕਰੀ ਜਾ ਰਿਹਾ ਹੈ ਪਰੰਤੂ ਫਿਰ ਵੀ ਉਹ ਵਿੱਚ ਵਿਚਾਲੇ ਜੇ ਹੀ ਕਿਤੇ ਘੁੰਮ ਰਿਹਾ ਹੈ ਉਸ ਨੂੰ ਆਸ ਦੀ ਕੋਈ ਉਮੀਦ ਨਹੀਂ ਦਿਖ ਰਹੀ ਉਹ ਚਾਹੁੰਦਾ ਤਾਂ ਹੈ ਕਿ ਉਸ ਦੇ ਸੁਪਨੇ ਪੂਰੇ ਹੋ ਜਾਣ ਪਰੰਤੂ ਜੋ ਨੀਤੀ ਉਸ ਨਾਲ ਖੇਡ ਖੇਡ ਰਹੀ ਹੈ ਉਹ ਉਸ ਨੂੰ ਅੱਗੇ ਨਹੀਂ ਆਉਣ ਦੇ ਰਹੀ ਸਭ ਕੁਛ ਕਰਨ ਦੇ ਬਾਅਦ ਵੀ ਉਸ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗਦੀ ਹੈ ਇਸ ਲਈ ਮੈਂ ਮੰਨਦਾ ਹਾਂ ਕਿ ਇਹ ਹਵਾਲਾ ਸ਼ਿਵ ਕੁਮਾਰ ਦੀ ਕਿਤਾਬ ਦਾ ਮੇਰੇ ਨਾਲ ਬਿਲਕੁਲ ਸੰਬੰਧਿਤ ਲੱਗਦਾ ਹੈ